ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਸੁਣਾਓ ਹਾਂਜੀ ਹਾਂਜੀ ਹੈਗੀਆਂ ਹੁਸ਼ਿਆਰਪੁਰ ਦੇ ਵਿੱਚ ਇੱਦਾਂ ਦੀਆਂ ਬਹੁਤ ਜਿਆਦਾ ਮਤਲਬ ਪਲੇਸਿਸ ਆ ਜਿੱਥੇ ਅਸੀਂ ਘੁੰਮ ਸਕਦੇ ਆਂ ਜਿੱਦਾਂ ਕਿ ਬਹੁਤ ਜਿਆਦਾ ਫੇਮਸ ਗੁਰਦੁਆਰੇ ਆ ਇੱਕ ਗੁਰਦੁਆਰਾ ਜਿੱਦਾਂ ਕਿ ਗਰਨਾ ਸਾਹਿਬ ਗੁਰਦੁਆਰਾ ਆ ਹਾਂਜੀ ਉਥੇ ਉਹ ਵੀ ਫੇਮਸ ਉੱਥੇ ਵੀ ਲੋਕ ਜਾਂਦੇ ਆ ਇੱਕ ਹਰੀਆਂ ਬੇਲਾ ਦੁਆਰਾ ਆ ਹਾਂਜੀ ਉਥੇ ਵੀ ਜਾ ਜਾਂਦੇ ਆ ਤੇ ਬਹੁਤ ਸਾਰੇ ਜਿੱਦਾਂ ਟੈਂਪਲ ਵੀ ਪੈਂਦੇ ਆ ਜਿਦਾਂ ਕੀ ਬੱਸ ਸਟੈਂਡ ਦੇ ਥੋੜੀ ਜਿਹੀ ਦੂਰ ਜਾ ਕੇ ਤਾਂ ਇੱਕ ਸ਼ਿਵ ਜੀ ਦਾ ਮੰਦਿਰ ਆਉਂਦਾ ਆ ਉਹ ਵੀ ਜਿਆਦਾ ਮਤਲਬ ਫੇਮਸ ਆ ਹਾਂਜੀ ਫਿਰ ਹੁਸ਼ਿਆਰਪੁਰ ਦੇ ਵਿੱਚ ਡੈਮ ਵੀ ਹੈਗਾ ਜਿਦਾਂ ਥੋੜਾ ਜਿਹਾ ਹੁਸ਼ਿਆਰਪੁਰ ਤੋਂ ਹੱਟ ਕੇ ਜਿੱਦਾਂ ਕਿ ਚੌਹਾਲ ਡੈਮ ਆ ਜਿਹਨੂੰ ਬੋਲਦੇ ਆਂ ਤੇ ਹਾਂਜੀ ਉਹ ਵੀ ਬਹੁਤ ਸਾਰੋ ਲੋੋਕ ਦੇਖਮ ਜਾਂਦੇ ਆ ਤੇ ਉੱਥੇ ਜਿੱਦਾ ਮਤਲਵ ਥੋੜਾ ਨਾਲ ਹੀ ਜਿੱਦਾਂ ਵੱਡਾ ਜਿਦਾਂ ਮਾਤਾ ਦਾ ਮੰਦਰ ਆ ਇਹ ਵੀ ਚੋਹਾਲ ਸਾਈਡ ਹੀ ਪੈਂਦਾ ਆ ਹਾਂਜੀ ਤੇ ਥੋੜਾ ਜਿਹਾ ਦੂਰ ਮਤਲਬ ਹੁਸ਼ਿਆਰਪੁਰ ਦੇ ਥੋੜਾ ਜਿਹਾ ਦੂਰ ਜਾ ਕੇ ਜਿਦਾਂ ਚਿੰਤਪੁਰਨੀ ਮਾਤਾ ਦਾ ਮੰਦਰ ਵੀ ਪੈਂਦਾ ਆ ਹਾਂਜੀ ਹੋਰ ਵੀ ਬਹੁਤ ਸਾਰੇ ਜਗ੍ਹਾ ਹੁੰਦੀਆਂ ਜਿਦਾਂ ਹੁਸ਼ਿਆਰਪੁਰ ਦੇ ਵਿੱਚ ਹੋਰ ਵੀ ਮਤਲਬ ਪਾਰਕ ਵੀ ਬਹੁਤ ਜਿਆਦਾ ਹੈਗੀਆਂ ਜਿੱਦਾਂ ਤੇ ਹਾਂਜੀ ਜਿੱਥੇ ਤੁਸੀਂ ਵਿਜਿਟ ਕਰ ਸਕਦੇ ਆ ਤੇ ਇੱਕ ਘੰਟਾ ਘਰ ਮਤਲਬ ਉਧਰਲੀ ਸਾਈਡ ਤੇ ਇੱਕ ਜਿੱਦਾਂ ਮਤਲਬ ਜਿਹਨੂੰ ਬੋਲਦੇ ਆ ਸ਼ੀਸ਼ ਮਹਿਲ ਬੋਲਦੇ ਆ ਉਹ ਵੀ ਪੈਂਦਾ ਆ ਉਥੇ ਜਿੱਦਾਂ ਕਿ ਪੁਰਾਣੀਆਂ ਚੀਜ਼ਾਂ ਨੇ ਨਾ ਪੁਰਾਣੇ ਜਮਾਨੇ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਨਾ ਉਹ ਉਹ ਮਤਲਬ ਉਹ ਦਿਖਾਈਆਂ ਜਾਂਦੀਆਂ ਆ ਉਹ ਵੀ ਬਹੁਤ ਜਿਆਦਾ ਮਤਲਬ ਫੇਮਸ ਆ ਲੋਕ ਉਥੇ ਦੇਖਣ ਆਉਂਦੇ ਆ ਹਾਂਜੀ ਕੁਝ ਕੁ ਮੈਂ ਜਿੱਦਾਂ ਕਿ ਚਿੜੀਆ ਘਰ ਬਾਰੇ ਵੀ ਸੁਣਿਆ ਵੀ ਜਿਹੜੇ ਹੁਸ਼ਿਆਰਪੁਰ ਏਰੀਏ ਦੇ ਵਿੱਚ ਹੈਗੇ ਆ ਹਾਂਜੀ ਤੇ ਹੋਰ ਵੀ ਬਹੁਤ ਸਾਰੇ ਜਿੱਦਾਂ ਦੇਖਣ ਵਾਲੀਆਂ ਪਲੇਸਸ ਆ ਜਿਹੜੀ ਜਿਹੜੀਆਂ ਕੀ ਕਈ ਮੈਂ ਵੀ ਵਿਜਿਟ ਨਹੀਂ ਕੀਤੀਆਂ ਬਟ ਮੈਂ ਕਈਆਂ ਤੋਂ ਸੁਣੀਆਂ ਪੀਆਂ ਆ ਹਾਂਜੀ ਹੋਰ ਜਿੱਦਾਂ ਕਈ ਡੈਮ ਜਿੱਦਾਂ ਮੈਂ ਸੁਣਿਆ ਇੱਕ ਨਾਰਾ ਡੈਮ ਆ ਫੋਰੈਸਟ ਡੈਮ ਆ ਤੇ ਹਾਂਜੀ ਇਹ ਵਾਲੇ ਵੀ ਡੈਮ ਆ ਬਟ ਮੈਂ ਵਿਜਿਟ ਨਹੀਂ ਕੀਤੀ ਬਟ ਮੈਂ ਲੋਕਾਂ ਤੋਂ ਇਹਨਾਂ ਬਾਰੇ ਸੁਣਿਆ ਹਾਂਜੀ

ਹਾਂਜੀ ਇੰਜਲ ਫਾਰਮ ਮੈਨੂੰ ਇਹਦੇ ਬਾਰੇ ਨਹੀਂ ਨੌਲੇਜ ਹੈਗੀ ਹਾਂ ਇੱਕ ਪਾਰਕ ਜਰੂਰ ਆ ਗਰੀਨ ਵਿਊ ਪਾਰਕ ਆ ਤੇ ਉਹ ਵੀ ਮੈਂ ਹੁਸ਼ਿਆਰਪੁਰ 'ਚ ਸੁਣੇ ਆ ਵੀ ਮਤਲਵ ਬਹੁਤ ਜਿਆਦਾ ਫੇਮਸ ਆ ਉੱਥੇ ਬਹੁਤ ਜਿਆਦਾ ਲੋਕ ਆਉਂਦੇ ਆ ਤੇ ਜੇ ਤੁਸੀਂ ਹੁਸ਼ਿਆਰਪੁਰ ਚ ਦੇਖਣ ਆਲੀਆ ਹੋਰ ਜਗਾ ਜਿੱਦਾਂ ਕਈ ਮੋਲ ਵਗੈਰਾ ਜਾਂ ਉਹ ਮੈਂ ਦੱਸ ਸਕਦੀ ਆਂ ਜਿੱਦਾਂ ਕਿ ਇੱਕ ਵੁਮਨ ਕਲੈਕਸ਼ਨ ਆ ਤੇ ਉਥੇ ਬਹੁਤ ਜਿਆਦਾ ਲੋਕ ਦਿੰਦੇ ਦਿਨ ਦੇ ਵਿਜਿਟ ਕਰਦੇ ਆ ਉਥੇ ਜਿੱਦਾਂ ਬਹੁਤ ਰੀਜਨੇਬਲ ਰੇਟ ਤੇ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਆ ਉਹ ਵੀ ਜਿੱਦਾਂ ਨਾ ਬੱਸ ਸਟੈਂਡ ਤੋਂ ਥੋੜਾ ਗਾਂਹ ਜਾ ਕੇ ਨਾ ਜਿੱਧਰ ਡੋਮੀਨੋਸ ਪੀਜ਼ਾ ਆ ਉਧਰਲੀ ਸਾਈਡ ਤੇ ਜਾ ਕੇ ਮਤਲਵ ਨਿਊ ਓਪਨ ਹੋਇਆ ਆ ਇਹ ਵੁਮੈਨ ਕਲੈਕਸ਼ਨ ਪਹਿਲਾਂ ਇਹ ਬੱਸ ਸਟੈਂਡ ਦੇ ਕੋਲ ਸੀਗਾ ਤੇ ਹੁਣ ਥੋੜਾ ਜਿਹਾ ਹੱਟ ਕੇ ਆ ਉਥੇ ਮਤਲਬ ਸਾਰਾ ਆਪਣਾ ਜਿਹੜਾ ਪਰਸਨਲ ਕੇਅਰ ਜਾਂ ਹੋਮ ਡੈਕੋਰ ਜਾਂ ਹੋਮ ਨਾਲ ਰਿਲੇਟਡ ਜਿਹੜਾ ਵੀ ਸਮਾਨ ਗਰੋਸਰੀ ਵਗੈਰਾ ਦਾ ਉੱਥੇ ਮਤਲਬ ਅਵੇਲੇਬਲ ਆ ਉਹ ਮਿਲਦਾ ਆ ਹਾਂਜੀ ਤੇ ਹੋਰ ਜਿਹੜਾ ਇੱਕ ਵਿਸ਼ਾਲ ਮੈਗਾ ਮਾਰਟ ਆ ਉਹ ਵੀ ਬਹੁਤ ਜਿਆਦਾ ਫੇਮਸ ਆ ਓਕੇ ਥੈਂਕਯੂ ਜੀ ਓਕੇ ਥੈਂਕਯੂ